ਮੈਂ ਜ਼ਿੰਦਗੀ ਵਿੱਚ ਸਭ ਤੋਂ ਵੱਧ ਕਦਰ ਸਮੇਂ ਦੀ ਕਰਦਾ ਹਾਂ ਕਿਉਂਕਿ ਸਮੇਂ ਬਹੁਤ ਹੀ ਜ਼ਿਆਦਾ ਕੀਮਤੀ ਹੁੰਦਾ ਹੈ ਅਤੇ ਆਪਣੇ ਪਿਤਾ ਜੀ ਦੀ ਵੀ ਬਹੁਤ ਕਦਰ ਕਰਦਾ ਹਾਂ ਜਿਹਨਾਂ ਦੀ ਬਦੌਲਤ ਅਸੀਂ ਅੱਜ ਇਸ ਦੁਨੀਆਂ ਵਿੱਚ ਆਏ ਅਤੇ ਸਾਡੇ ਦੇਸ਼ ਨੂੰ ਵੀ ਬਹੁਤ ਅੱਗੇ ਰੱਖਣਾ ਚਾਹੀਦਾ ਹੈ ਇਸ ਕਰਕੇ ਦੇਸ਼ ਦੀ ਵੀ ਬਹੁਤ ਕਦਰ ਕਰਦੇ ਹਾਂ